ਮੇਰੇ ਅਨੁਸਾਰ ਭੰਗੜਾ ਐਰੋਬੀਕ ਫਿਟਨੈਸ ਦੀ ਦੁਨੀਆ ਵਿੱਚ ਸ ਸ਼ਮੂਲੀਅਤ ਕਰਦਾ ਹੈ ਕਿਉਂਕਿ ਪਹਿਲਾਂ ਲੋਕ ਪਹਿਲਾਂ ਲੋਕ ਯੋਗਾ ਯੋਗਾ ਜ਼ਿਆਦਾ ਕਰਦੇ ਸੀ ਬਟ ਉਹ ਬੋਰ ਹੋ ਜਾਂਦੇ ਸੀ ਬਟ ਭੰਗ ਜਦੋਂ ਦਾ ਭੰਗੜਾ ਐਰੋਬਿਕ ਭੰਗੜਾ ਐਰੋਬੀਕ ਵਿੱਚ ਆਇਆ ਹੈ ਇਸ ਕਰਕੇ ਲੋਕ ਇੱਕ ਤਾਂ ਇਸਨੂੰ ਇੰਜੋਏ ਕਰਦੇ ਹਨ ਅਤੇ ਦੂਸਰਾ ਭੰਗੜੇ ਨੂੰ ਆਪਣੀ ਫਿਟਨੈਸ ਵੱਲ ਆਕਰਸ਼ਿਤ ਕਰਦੇ ਹਨ ਤਾਂ ਇਸ ਕਰਕੇ ਲੋਕ ਜ਼ਿਆਦਾ ਤੋਂ ਜ਼ਿਆਦਾ ਅਰੋਬਿਕ ਭੰਗੜੇ ਵੱਲ ਆਕਰਸ਼ਿਤ ਹੋ ਰਹੇ ਹਨ ਅਤੇ ਇਹ ਜੋ ਵੀ ਅਤੇ ਇਹ ਜੋ ਵੀ ਭੰਗੜਾ ਹੈ ਇਹ ਸਾਡੇ ਸਰੀਰ ਨੂੰ ਤੰਦਰੁਸਤ ਬਣਾਉਂਦਾ ਹੈ ਲਚਕ ਲਚਕਦਾਰ ਬਣਾਉਂਦਾ ਹੈ ਅਤੇ ਇਹ ਸਾਡੀ ਸਿਹਤ ਲਈ ਬਹੁਤ ਵਧੀਆ ਹਨ ਤਾਂ ਇਸ ਕਰਕੇ ਮੈਨੂੰ ਇਹ ਆਰੋਬਿਕ ਭੰਗੜਾ ਉਤਸ਼ਾਹਿਤ ਕਰਦਾ ਹੈ